ਸਤਿ ਸ਼੍ਰੀ ਅਕਾਲ ਜੀ ਮੈਂ ਹਰਮਨਦੀਪ ਕੌਰ ਬੋਲ ਰਹੀ ਹਾਂ ਤੁਸੀਂ ਭੋਲਾ ਹਲਵਾਈ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਤੋਂ ਅੱਜ ਬਾਰ੍ਹਾਂ ਵਜੇ ਦੇ ਕਰੀਬ ਇੱਕ ਔਡਰ ਕੀਤਾ ਸੀ ਜਿਹੜੀ ਤੁਹਾਡੀ ਐਪ ਹੈ ਸਵਿਗੀ ਤਾਂ ਫਿਰ ਜਿਹੜਾ ਮੇਰਾ ਔਡਰ ਸੀਗਾ ਉਹ ਤਕਰੀਬਨ ਹਜ਼ਾਰ ਰੁਪਏ ਦਾ ਬਣ ਰਿਹਾ ਉਹਦੇ 'ਚ ਮੈਂ ਗੁਲਾਬ ਜਾਮਣ ਸਮੌਸੇ ਬਰਫੀ ਡੋਸਾ ਪਾਓ ਭਾਜੀ ਇਡਲੀ ਸੰਭਰ ਇਹਨਾਂ ਦਾ ਸਾਰਾ ਔਡਰ ਬੁੱਕ ਕੀਤਾ ਸੀ ਅਤੇ ਹੁਣ ਔਡਰ ਬੁੱਕ ਕਰਨ ਤੋਂ ਬਾਅਦ ਜਦੋਂ ਮੈਂ ਤੁਹਾਡੀ ਐਪ 'ਤੇ ਜਿਹੜੀ ਸਵਿਗੀ ਵਾਲੀ ਹੈ ਜਦੋਂ ਪੇਮੈਂਟ ਦਾ ਜਦੋਂ ਆਪਸ਼ਨ ਜਦੋਂ ਕਲਿੱਕ ਕਰ ਰਹੇ ਹਾਂ ਤਾਂ ਫਿਰ ਉੱਥੇ ਜਿਹੜੀ ਮੇਰੀ ਔਨਲਾਈਨ ਪੇਮੈਂਟ ਹੈ ਉਹ ਵਾਰ ਵਾਰ ਰੱਦ ਹੋ ਰਹੀ ਹੈ ਸੋ ਇਸ ਕਰਕੇ ਮੇਰੇ ਲਈ ਇਹ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਕਿ ਵੀ ਮੈਂ ਆਪਣਾ ਜਿਹੜਾ ਤੁਹਾਡਾ ਭੁਗਤਾਨ ਹੈ ਉਹ ਕਰ ਸਕਾਂ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡਾ ਸਹੀ ਤਰੀਕੇ ਨਾਲ ਜਿੰਨਾ ਵੀ ਬਿੱਲ ਬਣਦਾ ਉਹਨੂੰ ਪੇ ਕਰ ਦੇਵਾਂ ਤਾਂ ਫਿਰ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਜੋ ਵੀ ਤੁਹਾਡਾ ਮਤਲਬ ਡਿਲੀਵਰੀ ਮੈਨ ਜੋ ਵੀ ਤੁਹਾਡਾ ਔਡਰ ਲੈ ਕੇ ਆਊਗਾ ਮੈਂ ਚਾਹੁੰਦੀ ਹਾਂ ਕਿ ਉਹ ਸਾਰਾ ਮਤਲਬ ਕੈਸ਼ ਔਨ ਡਿਲੀਵਰੀ ਜਿਹੜੀ ਹੋਊਗੀ ਤਾਂ ਫਿਰ ਮੈਂ ਸਾਰਾ ਭੁਗਤਾਨ ਦੇ ਦੇਵਾਂਗੀ ਤਾਂ ਕਿ ਨਾ ਹੀ ਮੈਨੂੰ ਕੋਈ ਦਿੱਕਤ ਆਵੇ ਕਿਉਂਕਿ ਮੇਰੇ ਘਰ ਵੀ ਬਹੁਤ ਸਾਰੇ ਮਹਿਮਾਨ ਆਏ ਹੋਏ ਅਤੇ ਮੈਨੂੰ ਤੁਹਾਡੇ ਜਿਹੜਾ ਤੁਹਾਡਾ ਹੈ ਤੁਹਾਡਾ ਰੈਸਟੋਰੈਂਟ ਉੱਥੋਂ ਦਾ ਖਾਣਾ ਬਹੁਤ ਵਧੀਆ ਲੱਗਦਾ ਮੈਂ ਨਹੀਂ ਚਾਹੁੰਦੀ ਕਿ ਮੈਨੂੰ ਆਪਣਾ ਕੋਈ ਵੀ ਡਿਸਅਪੋਇੰਟ ਕਰਨਾ ਪਵੇ ਆਪਣੇ ਮਹਿਮਾਨਾਂ ਨੂੰ ਜਾਂ ਤੁਹਾਨੂੰ ਤਾਂ ਕਰਕੇ ਇਹ ਸਾਰਾ ਔਡਰ ਕੀਤਾ ਜਾਵੇ